ਦੋ ਜਨਵਰੀ ਇੱਕ ਨੌਂ ਨੌਂ ਸੱਤ ਤਿੰਨ ਮਾਰਚ ਦੋ ਜੀਰੋ ਜੀਰੋ ਸੱਤ ਇੱਕ ਜੂਨ ਇੱਕ ਨੌਂ ਨੌਂ ਛੇ ਨੌਂ ਅਕਤੂਬਰ ਦੋ ਜੀਰੋ ਜੀਰੋ ਦੋ ਪੰਜ ਜਨਵਰੀ ਇੱਕ ਨੌਂ ਨੌਂ ਜੀਰੋ